ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਮੈਂ ਆਪਣੇ ਇਤਿਹਾਸ ਵਿੱਚ ਆਪਣੇ ਪੰਜਾਬ ਬਾਰੇ ਜਾਂ ਆਪਣੇ ਆਲੇ ਦੁਆਲੇ ਬਾਰੇ ਕਈ ਵਿਵਾਦ ਸੁਣੇ ਹਨ ਜੋ ਕਿ ਸਾਡੇ ਬਹੁਤ ਪੁਰਾਣੇ ਇਤਿਹਾਸ ਤੋਂ ਚਲਦੇ ਆ ਰਹੇ ਹਨ ਕਈ ਤਰ੍ਹਾਂ ਦੇ ਟਾਕਰੇ ਜਿਹੜੇ ਕਿ ਸਾਡੇ ਮੁਗਲਾਂ ਜਿੱਦਾਂ ਕਿ ਸਾਡੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਨਾਲ ਰਹੇ ਹਨ ਇਸ ਦਾ ਟਕਰਾਅ ਇਸ ਦੇ ਵਿੱਚੋਂ ਹੀ ਜੇ ਅਸੀਂ ਜਿੱਦਾਂ ਕਿ ਜਾਣਦੇ ਹਾਂ ਕਿ ਸੌਲਵੀਂ ਸਤਾਰਵੀਂ ਸਦੀ ਵਿੱਚ ਪੰਦਰਵੀਂ ਚੌਦਵੀਂ ਸਦੀ ਵਿੱਚ ਸਾਡੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਦੋਂ ਮੁਗਲ ਆਏ ਸੀ ਸਾਡੇ ਭਾਰਤ ਵਿੱਚ ਜਿਨ੍ਹਾਂ ਨੇ ਪੰਜਾਬ ਵਿੱਚ ਵੀ ਬਹੁਤ ਲੁੱਟਮਾਰ ਕੀਤੀ ਸਾਡੇ ਗੁਰਦੁਆਰੇ ਢਾਹੇ ਜਿੱਦਾਂ ਕਿ ਅਸੀਂ ਜਾਣਦੇ ਹਾਂ ਅਹਿਮਦ ਸ਼ਾਹ ਅਬਦਾਲੀ ਨੇ ਕੀ ਕੀਤਾ ਸੀ ਸਾਡੇ ਨਾਲ ਸਾਡੇ ਹਰਿਮੰਦਰ ਸਾਹਿਬ ਨੂੰ ਤੋੜਿਆ ਸੀ ਅਤੇ ਸਾਡਾ ਸਰੋਵਰ ਵੀ ਪੂਰ ਦਿੱਤਾ ਸੀ ਅਤੇ ਸਾਡੇ ਸੱਭਿਆਚਾਰ ਨੂੰ ਬਹੁਤ ਵੱਡੀ ਸੱਟ ਲਾਈ ਸੀ ਅਤੇ ਸਾਡੇ ਐਸੇ ਵਿਵਾਦਾਂ ਨਾਲ ਅਸੀਂ ਜਾਣਦੇ ਹਾਂ ਕਿ ਬਹੁਤ ਨੁਕਸਾਨ ਹੋਇਆ ਸਾਨੂੰ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਕੀ ਕਹਿੰਦੇ ਪਾਕਿਸਤਾਨ ਭਾਰਤ ਦੀ ਵੰਡ ਦੇ ਟਾਈਮ 'ਤੇ ਉਦੋਂ ਵੀ ਇੱਦਾਂ ਇਸ ਤਰ੍ਹਾਂ ਹੀ ਹੋਇਆ ਸੀ ਉਹਨਾਂ ਨੇ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਕੀਤੀ ਤਾਂ ਪੰਜਾਬ ਦਾ ਅੱਧੇ ਤੋਂ ਵੱਧ ਹਿੱਸਾ ਉੱਧਰ ਚਲਾ ਗਿਆ ਅਤੇ ਉਸ ਉਸ 'ਤੇ ਵੀ ਬਹੁਤ ਜ਼ਿਆਦਾ ਵਿਵਾਦ ਹੋਇਆ ਜੋ ਕਿ ਚੰਗਾ ਨਹੀਂ ਹੋਇਆ ਸਾਡੇ ਨਾਲ ਸਾਡਾ ਸੱਭਿਆਚਾਰ ਵੀ ਸਾਡੇ ਤੋਂ ਵੱਖ ਹੋ ਗਿਆ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਇਸ ਤੋਂ ਕਿ ਸਾਡੇ ਨਾਲ ਕੀ ਕੀ ਕੁਛ ਹੋਇਆ ਹੈ ਸਾਡੇ ਪ ਇਸ ਖੇਤਰ ਨਾਲ ਜੋ ਕਿ ਸਹੀ ਗੱਲ ਨਹੀਂ ਹੈ ਤੁਹਾਨੂੰ ਪਤਾ ਕਰਨਾ ਚਾਹੀਦਾ ਹੈ ਸਾਨੂੰ ਚੰਨ ਦੀ ਜ਼ਰੂਰਤ ਹੈ ਕਿ ਸਾਡੇ ਇਤਿਹਾਸ ਵਿੱਚ ਸਾਨੂੰ ਕੀ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਸੋ ਇਸ ਤਰ੍ਹਾਂ ਦੇ ਹੋਰ ਵੀ ਜੇ ਵਿਵਾਦ ਜਾਂ ਬਾਅਦ ਹੋਰ ਵੀ ਕਈ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਹੋਰ ਆਏ ਆਏ ਹਨ ਜਿੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਧੰਨਵਾਦ